ਹੈਲੋ ਕਿਵੇਂ ਹੈ ਸੌਰਵ ਹੋਰ ਸੁਣਾ ਕੀ ਕੀਤਾ ਫਿਰ ਅੱਜ ਅੱਛਾ

ਅੱਛਾ ਅੱਛਾ ਅਤੇ ਸਟੋ ਸਟੋਰੀ ਕਿਵੇਂ ਹਿਸਾਬ ਕਿਤਾਬ ਹੂੰ ਹੂੰ ਹੂੰ ਹੂੰ ਹੂੰ

ਅੱਛਾ ਅੱਛਾ ਚਲਾਕ ਬੜਾ ਉਹ ਹੈ ਨਾ ਅੱਛਾ ਹੂੰ ਹੂੰ ਹੂੰ ਹੂੰ ਹੂੰ ਹਾਂ ਹਾਂ ਅੱਛਾ ਅਤੇੇ ਰੇਟਿੰਗ ਰੇਟਿੰਗ ਕਿੰਨੀ ਕੁ ਦੇਵੇਗਾ ਬੁੱਕ ਨੂੰ ਪੰਜ ਵਟਾ ਪੰਜ ਅੱਛਾ ਅੱਛਾ ਹੂੰ ਹੂੰ ਅੱਛਾ ਵਧੀਆ ਬੁੱਕ ਆ ਵੀ ਪੜ੍ਹਨੀ ਚਾਹੀਦੀ ਹੈ ਨਾ ਅੱਛਾ ਵੀ ਅੱਛਾ ਵੀ ਹਾਰ ਨਹੀਂ ਮੰਨੀ ਉਹਨੇ ਹੂੰ

ਅੱਛਾ ਵੀ ਹਾਰ ਨਾ ਅੱਛਾ ਅੱਛਾ ਵੀ ਲਾਈਬਰੇਰੀ ਤੋਂ ਮਿਲੀ ਸੀ ਇਹ ਬੁੱਕ ਕੇ ਦੂਜੇ ਪਾਸੇ ਹੀ ਹੂੰ ਹੂੰ ਹੂੰ ਅੱਛਾ ਪੜ੍ਹਨੀ ਪਵੇਗੀ ਲੱਗਦਾ ਜਿਵੇਂ ਜਿਸ ਹਿਸਾਬ ਨਾਲ ਗੱਲਾਂ ਜਿਹੀਆਂ ਕਰੀ ਜਾਂਦਾ ਅੱਛਾ ਮੈਨੂੰ ਸੈਂਡ ਕਰਦੀ ਚੰਗਾ ਫਿਰ ਮੈਂ ਪੜੂੰਗਾ ਮੈਂ ਪੜ੍ਹਦਾ ਬੱਸ ਫਿਰ ਅੱਧੇ ਕ ਘੰਟੇ ਤੱਕ ਪੜੂੰਗਾ ਮੈਂ ਕੋਈ ਨਹੀਂ ਚੱਲ ਚੰਗਾ